ਸਾਡੇ ਪਿੰਡ ਬੈਲ ਗੱਡੀ ਦੀਆਂ ਦੋੜਾਂ ਬੱਕਰੇ ਅਤੇ ਕੁੱਕੜ ਦੀਆਂ ਲੜਾਈਆਂ ਕਰਵਾਈ ਜਾਂਦੀਆਂ ਹਨ ਮੈਂ ਇੱਕ ਵਾਰੀ ਆਪਣੇ ਦੋਸਤ ਨਾਲ ਕੁੱਕੜ ਦੀ ਲੜਾਈ ਦੇਖਣ ਗਿਆ ਸੀਗਾ ਇਸ ਵਿੱਚ ਕੁੱਕੜ ਨੂੰ ਲੜਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੁੱਕੜ ਨੂੰ ਸ਼ਰਾਬ ਪਿਲਾਈ ਜਾਂਦੀ ਹੈ ਸ਼ਰਾਬ ਪਿਲਾਉਣ ਤੋਂ ਬਾਅਦ ਕੁੱਕੜ ਨੂੰ ਲੜਨ ਵਾਸਤੇ ਛੱਡ ਦਿੱਤਾ ਜਾਂਦਾ ਹੈ ਇੱਕ ਕੁੱਕੜ ਦੂਜੇ ਕੁੱਕੜ ਨੂੰ ਠੂੰਗਾ ਮਾਰਦਾ ਹੈ ਠੂੰਗਾ ਮਾਰਦੇ ਮਾਰਦੇ ਇੱਕ ਦੂਜੇ ਦੇ ਕੁੱਕੜ ਦੀਆਂ ਬਹੁਤ ਸੱਟਾਂ ਲੱਗਦੀਆਂ ਹਨ ਉੱਥੇ ਲਹੂ ਲਹਾਣ ਹੋ ਜਾਂਦਾ ਹੈ ਜੋ ਕਿ ਮੈਨੂੰ ਬਿਲਕੁਲ ਹੀ ਠੀਕ ਨਹੀਂ ਲੱਗਿਆ ਇਸ ਤਰ੍ਹਾਂ ਕਰਨ ਨਾਲ ਜਾਨਵਰਾਂ ਦੇ ਨਾਲ ਬਹੁਤ ਧੱਕਾ ਕੀਤਾ ਜਾਂਦਾ ਹੈ ਜਾਨਵਰਾਂ ਨੂੰ ਕਾਫੀ ਦੁੱਖ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਿ ਗਲਤ ਗੱਲ ਹੈ ਸਰਕਾਰ ਨੂੰ ਜਿਹੜੇ ਲੋਕ ਇੱਦਾਂ ਦੇ ਲੜਾਈਆਂ ਕਰਵਾਉਂਦੇ ਹਨ ਸਰਕਾਰ ਨੂੰ ਉਹਨਾਂ ਉੱਤੇ ਕਾਨੂੰਨੀ ਤੌਰ 'ਤੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਅਤੇ ਉਹਨਾਂ ਉਹਨਾਂ ਖਿਲਾਫ ਕੇਸ ਕਰਨਾ ਚਾਹੀਦਾ ਹੈ